ਵੈਸੇ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਖਾਸ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਪਰ ਜੇਕਰ ਮੈਂ ਗੱਲ ਕਰਾਂ ਮੈਂ ਜਦੋਂ ਟਵੈਲਥ 'ਚ ਸੀ ਤਾਂ ਉਸ ਟਾਈਮ ਮੈਂ ਇੱਕ ਯੂਥ ਫੈਸਟੀਵਲ ਵਿੱਚ ਹਿੱਸਾ ਲਿੱਤਾ ਸੀਗਾ ਕਿ ਜਿਸ ਵਿੱਚ ਮੈਂ ਗਿੱਧਾ ਕਰਨਾ ਸੀ ਪਰ ਮੇਰੇ ਪ੍ਰੈਕਟਿਸ ਕਰਦੇ ਟਾਈਮ ਹੀ ਪੈਰ ਵਿੱਚ ਮੋਚ ਆ ਗਈ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਮੁਸ਼ਕਿਲ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਪ੍ਰੋਗਰਾਮ ਵੀ ਬਿਲਕੁਲ ਨਜ਼ਦੀਕ ਸੀਗਾ ਮੈਨੂੰ ਐਵੇਂ ਸੀ ਡਰ ਕਿ ਮੇਰਾ ਪੈਰ ਠੀਕ ਹੋਊਗਾ ਵੀ ਉਦੋਂ ਤੱਕ ਕਿ ਨਹੀਂ ਪਰ ਮੈਂ ਫਿਰ ਵੀ ਹੌਸਲਾ ਨਹੀਂ ਹਾਰਿਆ ਅਤੇ ਮੈਂ ਹਿੰਮਤ ਨਾਲ ਕੰਮ ਲਿੱਤਾ ਫਿਰ ਮੈਂ ਕਾਫੀ ਸਾਰੇ ਡੋਕਟਰਸ ਨੂੰ ਵੀ ਦਿਖਾਇਆ ਕਿ ਮੇਰਾ ਪੈਰ ਉਦੋਂ ਤੱਕ ਠੀਕ ਹੋ ਜਾਵੇ ਫਿਰ ਮੈਂ ਬਹੁਤ ਸਾਰੇ ਘਰੇਲੂ ਨੁਸਖੇ ਵੀ ਅਪਣਾਏ ਪਰ ਮੈਂ ਆਪਣਾ ਹੌਸਲਾ ਨਹੀਂ ਹਾਰਿਆ ਅਤੇ ਆਪਣੀ ਹਿੰਮਤ ਨਾਲ ਨਾ ਤਾਂ ਪ੍ਰੈਕਟਿਸ ਕਰਨੀ ਛੱਡੀ ਔਰ ਆਪਣੇ ਪੈਰ ਦਾ ਵੀ ਪੂਰਾ ਧਿਆਨ ਰੱਖਿਆ ਅਤੇ ਜਦੋਂ ਤੱਕ ਮੇਰਾ ਪ੍ਰੋਗਰਾਮ ਆਇਆ ਉਦੋਂ ਤੱਕ ਮੈਂ ਬਿਲਕੁਲ ਆਪਣਾ ਪੈਰ ਬਿਲਕੁਲ ਠੀਕ ਕਰ ਲਿਆ ਸੀ ਅਤੇ ਇਸ ਦੇ ਵਿੱਚ ਹੀ ਮੇਰੇ ਟੀਚਰਜ਼ ਅਤੇ ਮੇਰੇ ਹੋਰ ਕੋਡੀਨੇਟਰ ਸੀ ਜੋ ਵੀ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ